ਮੈਂ ਦੀਕਸ਼ਾ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਹਿਲਾਂ ਬੀ ਐਸ ਐਨ ਐਲ ਦੀ ਸਿਮ ਇਸਤੇਮਾਲ ਕਰ ਰਹੀ ਹਾਂ ਪਰ ਮੈਨੂੰ ਇਸ ਸਿਮ ਦੇ ਨੈਟਵਰਕ ਤੋਂ ਸਰਟੀਸਫੈਕਸ਼ਨ ਨਹੀਂ ਹੈ ਕਿਉਂਕਿ ਇਸਦੇ ਨੈਟਵਰਕ ਨਹੀਂ ਮਿਲਦੇ ਹਨ ਅਤੇ ਮੈਂ ਹੁਣ ਇਹ ਵਿਚਾਰ ਕਰ ਰਹੀ ਹਾਂ ਕਿ ਮੈਂ ਇਹ ਸਿਮ ਬਦਲ ਦੇਵਾਂ ਤਾਂ ਮੈਨੂੰ ਇੱਕ ਮੈਂਬਰ ਨੇ ਇਹ ਸਲਾਹ ਦਿੱਤੀ ਕਿ ਮੈਂ ਬੀ ਐਸ ਐਨ ਐਲ ਦੀ ਸਿਮ ਨੂੰ ਛੱਡ ਕੇ ਜੀਓ ਦੀ ਸਿਮ ਲੈ ਲਵਾਂ ਜਿਸ ਦਾ ਨੈਟਵਰਕ ਬਹੁਤ ਚੰਗਾ ਹੈ ਅਤੇ ਹਰ ਜਗ੍ਹਾ ਮਿਲ ਜਾਂਦਾ ਹੈ ਪਰ ਹੁਣ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜੀਓ ਸਿਮ ਦੀ ਯੋਜਨਾ ਕੀ ਹੈ ਅਤੇ ਉਸਦਾ ਮਹੀਨੇ ਦਾ ਬਿੱਲ ਕਿੰਨਾ ਕੁ ਆ ਸਕੇਗਾ ਤਾਂ ਉਸਨੇ ਮੈਨੂੰ ਦੱਸਿਆ ਕਿ ਜੀਓ ਦਾ ਨੈਟਵਰਕ ਬਹੁਤ ਅੱਛਾ ਹੈ ਅਤੇ ਉਸ ਦਾ ਬਿਲ ਜੋ ਹੈ ਉਹ ਮਹੀਨੇ ਦਾ ਇੱਕ ਰਿਚਾਰਜ ਦੇ ਅਨੁਸਾਰ ਹੀ ਆਵੇਗਾ ਅਤੇ ਤੁਹਾਨੂੰ ਉਸ ਸਿਮ ਦੇ ਵਿੱਚ ਚੰਗਾ ਇੰਟਰਨੈਟ ਫਾਇਵ ਜੀ ਹੀ ਮਿਲੇਗਾ ਜੋ ਕਿ ਤੁਹਾਨੂੰ ਚੰਗੀ ਸਪੀਡ ਦੇਵੇਗਾ ਕਿਸੇ ਚੀਜ਼ ਨੂੰ ਡਾਊਨਲੋਡ ਕਰਨ ਲਈ ਅਤੇ ਮੇਰੇ ਵੱਲੋਂ ਜੋ ਵੀ ਸਿਮ ਬਦਲਣ ਦਾ ਵਿਚਾਰ ਸੀ ਉਹਦੇ ਸਾਰੇ ਜੋ ਉੱਤਰ ਸੀ ਉਹ ਮੈਨੂੰ ਮਿਲ ਗਏ ਇਸ ਲਈ ਮੈਂ ਜੋ ਹੈ ਆਪਣੀ ਸਿਮ ਬੀ ਐਸ ਐਨ ਐਲ ਨੂੰ ਛੱਡ ਕੇ ਹੁਣ ਜੀਓ ਵਿੱਚ ਕਰਵਾ ਲਵਾਂਗੀ ਧੰਨਵਾਦ